ਹਾਂਜੀ ਸਰ ਸਵੀਗੀ ਤੋਂ ਗੱਲ ਕਰ ਰਹੇ ਹਾਂਜੀ ਸਰ ਇੱਕ ਨਾ ਮੇਰਾ ਅਕਾਊਂਟ ਹੈ ਜੀ ਉਹ 'ਤੇ ਨਾ ਆਟੋ ਪੇਅ ਲੱਗਿਆ ਹੋਇਆ ਹੈਗਾ ਅਤੇ ਮੈਂ ਆਟੋ ਪੇਅ ਹਟਵਾਉਣਾ ਗਾ ਕਿਉਂਕਿ ਮੈਂ ਜ਼ਿਆਦਾ ਕੈਸ਼ ਔਨ ਡਿਲੀਵਰੀ ਨੂੰ ਪਰੈਫਰ ਕਰਦਾ ਗਾ ਜੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਕਾਊਂਟ 'ਚ ਪੈ ਅਕਾਊਂਟ 'ਚ ਪੈਸੇ ਨਹੀਂ ਹੁੰਦੇ ਤਾਂ ਫਿਰ ਉਹ ਦਿੱਕਤ ਆ ਜਾਂਦੀ ਹੈਗੀ ਵੀ ਹੋਰ ਅਕਾਊਂਟ 'ਚ ਪੈ ਕਰਨੀ ਹੁੰਦੀ ਆ ਪੇਮੈਂਟ ਅਤੇ ਇਹਦਾ ਸਰ ਕੀ ਪ੍ਰੋਸੀਜਰ ਆ ਗਾ ਕਿਵੇਂ ਹਟੇਗੀ ਅਤੇ ਉਹ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਸਰ ਕਿੰਨੇ ਕੁ ਦਿਨਾਂ ਦਾ ਸਰ ਇਹ ਪ੍ਰੋਸੀਜਰ ਹੈਗਾ ਜੀ ਸਾਰਾ ਕਿੰਨੇ ਦਿਨਾਂ 'ਚ ਹਟ ਜਾਵੇਗੀ ਅਤੇ ਦੁਬਾਰਾ ਸਰ ਇਸ ਤਰ੍ਹਾਂ ਦਾ ਕੋਈ ਕੌਲ ਕਰਨੀ ਪਈ ਜੀ ਕਸਟਮਰ ਕੇਅਰ ਨੂੰ ਜਾਂ ਕੋਈ ਮੈਨੂੰ ਮੈਸੇਜ ਆਵੇਗਾ ਇਸਦਾ ਹਟੇ ਦਾ ਜਾਂ ਕੋਈ ਈਮੇਲ ਆਵੇਗੀ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਓਕੇ ਸਰ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ